ਹੈਲੋ ਸਤਿ ਸ਼੍ਰੀ ਅਕਾਲ ਸ ਸਰ ਮੈਨੂੰ ਕੁਕਿੰਗ ਕਰਨ ਦਾ ਬਹੁਤ ਸ਼ੌਂਕ ਹੈ ਜਿਸ ਕਰਕੇ ਮੈਂ ਰੋਜ਼ਾਨਾ ਆਪਣੇ ਘਰ ਵਿੱਚ ਕੁਕਿੰਗ ਕਰਦੀ ਹਾਂ ਅਤੇ ਕੁਕਿੰਗ ਕਰਨ ਵੇਲੇ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਬਜ਼ੀ ਵਧੀਆ ਹੋਵੇ ਸਾਫ ਸੁਥਰੀ ਹੋਵੇ ਕਿਚਨ ਸਾਫ ਸੁਥਰਾ ਹੋਵੇ ਭਾਂਡੇ ਸਾਫ ਸੁਥਰੇ ਹੋਣ ਤਾਂ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਖਾਣਾ ਬਣਾਉਣ ਵੇਲੇ ਬੱਚਿਆਂ ਨੂੰ ਕਿਚਨ ਤੋਂ ਦੂਰ ਰੱਖਣਾ ਚਾਹੀਦਾ ਹੈ ਸਿਲੰਡਰ ਤੋਂ ਦੂਰ ਰੱਖਣਾ ਚਾਹੀਦਾ ਹੈ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸਬਜ਼ੀ ਸ ਧੋ ਕੇ ਕੱਟਣੀ ਚਾਹੀਦੀ ਹੈ ਅਤੇ ਰੋਟੀ ਵੀ ਸਾਫ ਹੱਥਾ ਹੱਥਾਂ ਨਾਲ ਬਣਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਬਿਮਾਰੀਆਂ ਫੈਲਣ ਤੋਂ ਰੋਕ ਦੂਰ ਬਿਮਾਰੀਆਂ ਨਾ ਫੈਲ ਸਕੇ ਅਤੇ ਹਰ ਚੀਜ਼ ਸਾਫ ਸੁਥਰੀ ਹੋਣੀ ਚਾਹੀਦੀ ਹੈ ਅਤੇ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ ਅਤੇ ਅਤੇ ਖਾਣਾ ਬਣਾਉਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਸਿਲੰਡਰ ਗੈਸ ਬੰਦ ਹੈ ਜਾਂ ਨਹੀਂ